ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹਦੀ ਕਲਾ ਅਤੇ ਸ਼ਿਲਪਕਾਰੀ ਪੂਰੇ ਮੁਲਖ ਵਿੱਚ ਪੂਰੇ ਵਰਲਡ ਵਿੱਚ ਮਸ਼ਹੂਰ ਹੈ ਪੰਜਾਬ ਵਿੱਚ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਇਹਨਾਂ ਨਾਲ ਜੁੜਨ ਦਾ ਇੱਕੋ ਇੱਕ ਮੌਕਾ ਅਸੀਂ ਦੇ ਸਕਦੇ ਹਨ ਜੀ ਜਿੱਦਾਂ ਕਿ ਅਸੀਂ ਆਪਣੀ ਕਲਾ ਅਤੇ ਸ਼ਿਲਪਕਾਰੀ ਇਹਦੀ ਪ੍ਰਦਰਸ਼ਨੀ ਥਾਂ ਥਾਂ 'ਤੇ ਕਰੀਏ ਜਿੱਦਾਂ ਕਿ ਹੋ ਗਿਆ ਕਿ ਜਿੱਦਾਂ ਬੱਸ ਸਟੈਂਡ ਦੇ ਲਾਗੇ ਭੀੜ ਭੜਾਕੇ ਵਾਲੇ ਰਾ ਇਲਾਕੇ ਵਿੱਚ ਜਾਂ ਰੇਲਵੇ ਸਟੇਸ਼ਨ ਦੇ ਲਾਗੇ ਜਾਂ ਕਿ ਜਿੱਦਾਂ ਗੋਲ ਸ਼ਹਿਰ ਦੀ ਐਂਟਰਸ 'ਤੇ ਇਹਨਾਂ ਚੀਜ਼ਾਂ ਦੀ ਪ੍ਰਦਰਸ਼ਨੀ ਕਰਕੇ ਅਸੀਂ ਲੋਕਾਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਅਤੇ ਇਹਨਾਂ ਨੂੰ ਆਪਣੀ ਕਲਾ ਅਤੇ ਸ਼ਿਲਪਕਾਰੀ ਨਾ ਤੋਂ ਪ੍ਰੇਰਿਤ ਕਰ ਸਕਦੇ ਹਨ ਤਾਂ ਕਿ ਇਹ ਸਾਡੀ ਕਲਾ ਅਤੇ ਸ਼ਿਲਪਕਾਰੀ ਦੀ ਪ੍ਰਸ਼ੰਸਾ ਸਾਰੇ ਮੁਲਖ ਵਿੱਚ ਜਾ ਕੇ ਕਰਨ